ਮੇਰਾ ਨਾਮ ਅੰਮ੍ਰਿਤਪਾਲ ਕੌਰ ਹੈ ਮੈਂ ਗਾਹਕ ਸਹਾਇਤਾ ਨਾਲ ਗੱਲ ਕਰ ਰਹੀ ਹਾਂ ਮੈਂ ਇਹ ਜਾਣਕਾਰੀ ਲੈਣਾ ਚਾਹੁੰਦੀ ਹਾਂ ਕਿ ਮੈਂ ਆਪਣਾ ਬਿੱਲ ਵੀਹ ਅਕਤੂਬਰ ਦੋ ਹਜ਼ਾਰ ਚੌਵੀ ਨੂੰ ਜਮ੍ਹਾ ਕਰਵਾਇਆ ਸੀ ਜਿਸ ਦੀ ਮੈਂ ਰਾਸ਼ੀ ਨੈਟ ਬੈਂਕਿੰਗ ਰਾਹੀਂ ਕੀਤੀ ਸੀ ਜਿਸ ਨੂੰ ਮੈਂ ਅਪਲੋਡ ਵੀ ਵੀਹ ਅਕਤੂਬਰ ਦੋ ਹਜ਼ਾਰ ਚੌਵੀ ਨੂੰ ਕਰਵਾਇਆ ਹੈ ਜੋ ਅਜੇ ਤੱਕ ਜਮ੍ਹਾ ਨਹੀਂ ਹੋਇਆ ਜੇਕਰ ਮੇਰੀ ਇਹ ਸਮੱਸਿਆ ਦਾ ਹੱਲ ਇੱਕ ਨਵੰਬਰ ਤੱਕ ਨਹੀਂ ਕੀਤਾ ਗਿਆ ਤਾਂ ਕੀ ਮੈਨੂੰ ਇਸ ਦਾ ਵਿਆਜ ਪਵੇਗਾ ਮੇਰੀ ਬੈਂਕ ਰਾਸ਼ੀ ਦਸ ਹਜ਼ਾਰ ਸੱਤ ਸੌ ਵੀਹ ਰੁਪਏ ਸੀ ਮੇਰਾ ਫੋਨ ਨੰਬਰ ਬਾਹਟ ਅੱਠ ਉਣੰਜਾ ਸੱਤਰ ਚਾਰ ਤਰਤਾਲੀ ਹੈ ਮੇਰੀ ਸਮੱਸਿਆ ਦਾ ਹੱਲ ਜਲਦ ਤੋਂ ਜਲਦ ਕੀਤਾ ਜਾ ਸਕੇ ਮੈਂ ਜੇਕਰ ਮੇਰੀ ਸਮੱਸਿਆ ਦਾ ਹੱਲ ਜਲਦ ਤੋਂ ਜਲਦ ਕੀਤਾ ਜਾਵੇਗਾ ਤਾਂ ਮੈਂ ਆਪ ਜੀ ਦੀ ਬਹੁਤ ਧੰਨਵਾਦੀ ਹੋਵਾਂਗੀ ਮੇਰਾ ਨਾਮ ਅੰਮ੍ਰਿਤਪਾਲ ਕੌਰ ਹੈ ਮੇਰਾ ਮੋਬਾਇਲ ਨੰਬਰ ਬਾਹਟ ਅੱਠ ਉਣੰਜਾ ਸੱਤਰ ਚਾਰ ਤਰਤਾਲੀ ਹੈ